ਪਸ਼ੂਆਂ ਦੇ ਪਰਜਨਨ ਦੋ ਤਰੀਕੇ ਨਾਲ ਹੀ ਕੀਤੇ ਜਾਂਦੇ ਹਨ ਜਿਵੇਂ ਕਿ ਅੱਗੇ ਪਿੰਡ ਦੇ ਵਿੱਚ ਕੋਈ ਢੱਠੇ ਵਗੈਰਾ ਤੋਂ ਗਾਂ ਦਾ ਪ੍ਰਜਨਨ ਕਰਾਉਣਾ ਜਾਂ ਕੋਈ ਮੱਝ ਦਾ ਪੈਂਸੇ ਤੋਂ ਕਰਵਾਉਣਾ ਜਾਂ ਹੁਣ ਤਾਂ ਉਹ ਪਹਿਲੇ ਸਮੇਂ ਦੀ ਗੱਲ ਹੁੰਦੀ ਸੀ ਕਿ ਵੀ ਇੱਦਾਂ ਹੁੰਦੇ ਸੀਗੇ ਜਾਂ ਘਰ ਵਿੱਚ ਹੀ ਕੋਈ ਸਾਨ੍ਹ ਰੱਖਿਆ ਹੁੰਦਾ ਸੀ ਪਰ ਹੁਣ ਸਾਡੇ ਇਹ ਹੈਗਾ ਵਾ ਕਿ ਵੀ ਆਪਾਂ ਟੀਕਾਕਰਨ ਹੀ ਹੁੰਦਾ ਵਾ ਹਸਪਤਾਲਾਂ ਦੇ ਵਿੱਚ ਬਹੁਤ ਵਧੀਆ ਵਧੀਆ ਯਾਨੀ ਕਿ ਟੀਕਾ ਟੀਕੇ ਆਏ ਹੋਏ ਨੇ ਜਿਵੇਂ ਅਮਰੀਕਨ ਜਾਂ ਕੋਈ ਜਰਸੀ ਵਗੈਰਾ ਦੇ ਜਾਂ ਇੱਦਾਂ ਟੀਕੇ ਹੀ ਕਰਾਏ ਜਾਂਦੇ ਹਨ ਅਤੇ ਸਾਡੇ ਇਲਾਕੇ ਦੇ ਵਿੱਚ ਤਾਂ ਜ਼ਿਆਦਾਤਰ ਟੀਕਾਕਰਨ ਹੀ ਹੁੰਦਾ ਹੈ ਹੁਣ ਕੋਈ ਵੀ ਬੁੱਲ ਤੋਂ ਜਾਂ ਕਿਸੇ ਤੋਂ ਵੀ ਨਹੀਂ ਕਰਵਾਉਂਦੇ ਯਾਨੀ ਕਿ ਟੀਕੇ ਤੋਂ ਹੀ ਪ੍ਰਜਨਨ ਕਰਵਾਏ ਜਾਂਦੇ ਹਨ